ਰੂਪਨਗਰ ਜ਼ਿਲ੍ਹੇ ਵਿੱਚ ਮੁੱਖ ਖੇਤੀਬਾੜੀ ਉਤਪਾਦ ਜਿਵੇਂ ਕਿ ਗੰਨਾ ਕਣਕ ਚੌਲ਼ ਮੁੱਖ ਤਾਂ ਇਹੀ ਹਨ ਇਹ ਇਹਨਾਂ ਦੀ ਖੇਤੀ ਜਿਵੇਂ ਕਿ ਟਰੈਕਟਰਾਂ ਨਾਲ ਕੀਤੀ ਜਾਂਦੀ ਹੈ ਟਰੈਕਟਰਾਂ ਤੋਂ ਬਾਅਦ ਪਹਿਲਾਂ ਬਲਦਾਂ ਨਾਲ ਖੇਤੀ ਕੀਤੀ ਜਾਂਦੀ ਸੀ ਹੁਣ ਕਨ ਟਰੈਕਟਰ ਨਾਲ ਕੀਤੀ ਜਾਂਦੀ ਹੈ ਅਤੇ ਸਿੰਚਾਈ ਦੇ ਸਾਧਨ ਜਿਵੇਂ ਕਿ ਨਹਿਰਾਂ ਟਿਊਬਵੈਲਾਂ ਅਤੇ ਸੂਇਆਂ ਨਾਲ ਸਿੰਚਾਈ ਕੀਤੀ ਜਾਂਦੀ ਹੈ